ਹੈਲੋ ਹਾਂਜੀ ਹਾਂਜੀ ਮੈਮ ਕੀ ਹਾਲ ਹੈ ਹੋਰ ਸੁਣਾਓ ਕਿੱਦਾਂ ਚੱਲ ਰਿਹਾ ਹਾਂਜੀ ਹਾਂਜੀ ਵਧੀਆ ਚੱਲ ਰਿਹਾ ਹੈ ਅਤੇ ਮੈਂ ਪੁੱਛਣਾ ਸੀ ਕਿ ਤੁਹਾਡੇ ਕੋਲ ਐਡਮਿਸ਼ਨਸ ਕਿੰਨੀਆਂ ਆ ਰਹੀਆਂ ਨੇ

ਅੱਛਿਆ ਜੀ ਸਾ ਠੀਕ ਹੈ ਜੇ ਸਾਡੇ ਕੋਲ ਨਾ ਐਡਮਿਸ਼ਨਸ ਘੱਟ ਆ ਰਹੀਆਂ ਨੇ ਤੁਹਾਡੇ ਕਿਸ ਫੀਲਡ 'ਚ ਜ਼ਿਆਦਾ ਆ ਰਹੀਆਂ ਨੇ ਐਡਮਿਸ਼ਨਸ ਠੀਕ ਹੈ ਜੀ ਅਤੇ ਕੁਛ ਮੈਮ ਕੁਛ ਖਾਸ ਗੱਲਾਂ ਜੋ ਮੈਨੂੰ ਦੱਸੋ ਤੁਸੀਂ ਕਿ ਮੈਂ ਕਿੱਦਾਂ ਬੱਚਿਆਂ ਨੂੰ ਅਟਰੈਕਟ ਕਰਾਂ ਐਡਮਿਸ਼ਨ ਵਾਸਤੇ ਆਪਣੇ ਕੋਲੇਜ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਮੈਮ ਤੁਹਾਡਾ ਬਹੁਤ ਬਹੁਤ